ਜਿਵੇਂ ਕਿ ਮੀਡੀਆ ਦੀ ਗੱਲ ਕੀਤੀ ਜਾਵੇ ਮੈਂ ਤਰਨ ਤਾਰਨ ਸ਼ਹਿਰ ਦੇ ਵਿੱਚ ਰਹਿੰਦੀ ਹਾਂ ਤਰਨ ਤਾਰਨ ਦੇ ਵਿੱਚ ਵੱਖ ਵੱਖ ਮੀਡੀਆ ਚੈਨਲਸ ਆ ਅਖ਼ਬਾਰਾਂ ਆਉਂਦੀਆਂ ਜਿਵੇਂ ਕਿ ਜੱਗ ਬਾਣੀ ਪੰਜਾਬੀ ਜਾਗਰਣ ਅਜੀਤ ਜਿਹਨਾਂ ਦੇ ਵਿੱਚ ਕਿ ਰੋਜ਼ਾਨਾ ਖ਼ਬਰਾਂ ਆਉਂਦੀਆਂ ਵਾਂ ਲੇਟੈਸਟ ਅਪਡੇਟਸ ਮਿਲਦੀਆਂ ਵਾਂ ਅਤੇ ਨਿਊਜ਼ ਚੈਨਲ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਪੀ ਟੀ ਸੀ ਨਿਊਜ਼ ਪੀ ਟੀ ਸੀ ਨਿਊਜ਼ 'ਤੇ ਵੀ ਵੱਖ ਵੱਖ ਜ਼ਿਲ੍ਹਿਆ ਦੀਆਂ ਵੱਖ ਵੱਖ ਦੇਸ਼ਾਂ ਦੀਆਂ ਖ਼ਬਰਾਂ ਜਾਨਣ ਨੂੰ ਮਿਲਦੀਆਂ ਜਿਹਦੇ 'ਚ ਕਿ ਹਰ ਇੱਕ ਏਰੀਏ ਦੇ ਆਪਾਂ ਨੂੰ ਅਪਡੇਟ ਮਿਲਦੀ ਹੈ ਨੌਲੇਜ ਮਿਲਦੀ ਹੈ ਕਰੰਟ ਅਫੇਅਰਸ ਬਾਰੇ ਪਤਾ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਕੀ ਪੋਲਿਸੀਜ ਚੱਲਣ ਦੀਆਂ ਪਈਆਂ ਆ ਕੀ ਚੇਂਜਿਸ ਆਏ ਆ ਕੀ ਹਾਦਸੇ ਹੋਏ ਆ ਕਿੱਥੇ ਹਾਦਸਾ ਹੋਇਆ ਕਿਉਂ ਹਾਦਸਾ ਹੋਇਆ ਹਰ ਜਗ੍ਹਾ ਦੇ ਆਪਾਂ ਨੂੰ ਬਾਰੇ ਜਾਣਕਾਰੀ ਮਿਲ ਜਾਂਦੀ ਆ ਭਾਵੇਂ ਆਪਣੇ ਤਰਨ ਤਾਰਨ ਜ਼ਿਲ੍ਹੇ ਦੀ ਹੋਵੇ ਭਾਵੇਂ ਕੋਈ ਹੋਰ ਜ਼ਿਲ੍ਹੇ ਦੀ ਹੋਵੇ ਹਰ ਕੋਈ ਖ਼ਬਰ ਹਰ ਕੋਈ ਜਾਣਕਾਰੀ ਆਪਾਂ ਨੂੰ ਨਿਊਜ਼ ਚੈਨਲਾਂ ਦੇ ਨਾਲ ਮਿਲ ਜਾਂਦੀ ਆ ਮੀਡੀਆ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈਗਾ ਮੀਡੀਆ ਦੇ ਨਾਲ ਆਪਾਂ ਨੂੰ ਦੇਸ਼ ਵਿਦੇਸ਼ ਦੀ ਜਾਣਕਾਰੀ ਮਿਲਦੀ ਆ ਆਪਾਂ ਨੂੰ ਉਹ ਵੀ ਘਰ ਬੈਠਿਆ ਆਪਾਂ ਨੂੰ ਰੋਜ਼ ਅਖ਼ਬਾਰ ਘਰ ਦੇ ਵਿੱਚ ਆਉਂਦੀ ਆ ਜਿਹਦੇ ਵਿੱਚ ਕਿ ਆਪਾਂ ਨੂੰ ਬਿਜ਼ਨਸ ਬਾਰੇ ਕਰੰਟ ਅਫੇਅਰਸ ਬਾਰੇ ਕਿੱਥੇ ਕੀ ਹੋਇਆ ਜਾਂ ਕੀ ਹੋਣ ਵਾਲਾ ਆ ਸਭ ਕੁਛ ਪਤਾ ਲੱਗਦਾ ਵਾ ਜੋ ਕਿ ਬਹੁਤ ਜ਼ਰੂਰੀ ਹੈਗਾ ਵਾ ਆਪਾਂ ਨੂੰ ਹਮੇਸ਼ਾ ਅਪ ਟੂ ਡੇਟ ਰਹਿਣਾ ਚਾਹੀਦਾ ਜੋ ਕਿ ਆਪਾਂ ਮੀਡੀਆ ਦੇ ਮਾਧਿਅਮ ਤੋਂ ਰਹਿ ਸਕਦੇ ਹਾਂ